ਹੈਲੋ ਮੈਂ ਸਿਮਰਪ੍ਰੀਤ ਸਿੰਘ ਹਾਂ ਅਤੇ ਮੈਂ ਦੱਸਣਾ ਚਾਹੁੰਦਾ ਹਾਂ ਕਿ ਟੈਕਨੋਲਜੀ ਨੇ ਛੋਟੇ ਕਾਰੋਬਾਰਾਂ ਦੇ ਵਿਕਾਸ ਵਿੱਚ ਕੀ ਮਦਦ ਕੀਤੀ ਹੈ ਟੈਕਨੋਲਜੀ ਨੇ ਛੋਟੇ ਕਾਰੋਬਾਰਾਂ ਦੇ ਵਿਕਾਸ ਵਿੱਚ ਬਹੁਤ ਮਦਦ ਕੀਤੀ ਹੈ ਜਿਵੇਂ ਕਿ ਜਦੋਂ ਛੋਟਾ ਕਾਰੋਬਾਰ ਸ਼ੁਰੂ ਹੁੰਦਾ ਹੈ ਤਾਂ ਉਸਨੂੰ ਕੋਈ ਨਹੀਂ ਜਾਣਦਾ ਹੁੰਦਾ ਟੈਕਨੋਲਜੀ ਦੇ ਇੰਟਰਨੈੱਟ ਕਾਰਨ ਲੋਕ ਛੋਟੇ ਕਾਰੋਬਾਰ ਆਪਣਾ ਕੰਮ ਜੋ ਵੀ ਕੁਝ ਉਹ ਵੇਚਦੇ ਹਨ ਅਤੇ ਕੰਮ ਕਰਦੇ ਹਨ ਉਹ ਇੰਟਰਨੈੱਟ 'ਤੇ ਪਾ ਸਕਦੇ ਹਨ ਤਾਂ ਜੋ ਲੋਕ ਉਹਨਾਂ ਬਾਰੇ ਜਾਣ ਸਕਣ ਅਤੇ ਉਹ ਗੂਗਲ ਮੈਪ ਉੱਤੇ ਆਪਣੀ ਦੁਕਾਨ ਦਾ ਐਡਰੈੱਸ ਪਾ ਸਕਦੇ ਹਨ ਤਾਂ ਜੋ ਲੋਕ ਉਹਨਾਂ ਦੀ ਦੁਕਾਨ ਉੱਤੇ ਆ ਸਕਣ ਅਤੇ ਉਹਨਾਂ ਤੋਂ ਸਮਾਨ ਖਰੀਦ ਸਕਣ ਇਸ ਤਰ੍ਹਾਂ ਟੈਕਨੋਲੋਜੀ ਛੋਟੇ ਕਾਰੋਬਾਰਾਂ ਨੂੰ ਵਧਣ ਵਿੱਚ ਬਹੁਤ ਹੀ ਫਾਇਦਾ ਕਰਦੀ ਹੈ ਮੈਂ ਇੱਕ ਕਾਰੋਬਾਰ ਚਲਾਉਂਦਾ ਹਾਂ ਜੋ ਕਿ ਕਲਾਊਡ ਕਿਚਨ ਦਾ ਕਾਰੋਬਾਰ ਹੈ ਇਸ ਵਿੱਚ ਮੈਂ ਆਪਣੇ ਘਰ ਵਿੱਚ ਖਾਣਾ ਬਣਾ ਕੇ ਲੋਕਾਂ ਨੂੰ ਸਪਲਾਈ ਕਰਦਾ ਹਾਂ ਇਸ ਵਿੱਚ ਟੈਕਨੋਲਜੀ ਵਾਲੇ ਐਪ ਜਿਵੇਂ ਕਿ ਜ਼ੋਮੈਟੋ ਅਤੇ ਸਵੀਗੀ ਨੇ ਮੈਨੂੰ ਬਹੁਤ ਹੀ ਮਦਦ ਕੀਤੀ ਹੈ ਮੈਂ ਇਹਨਾਂ ਦੋਨਾਂ ਐਪਾਂ ਨਾਲ ਜੁੜ ਕੇ ਲੋਕਾਂ ਤੋਂ ਔਡਰ ਲੈਂਦਾ ਹਾਂ ਅਤੇ ਉਨ੍ਹਾਂ ਦੇ ਘਰਾਂ ਤੱਕ ਛੇਤੀ ਤੋਂ ਛੇਤੀ ਪਹੁੰਚਾਉਣ ਦੀ ਕੰਮ ਕਰਦਾ ਹਾਂ ਇਹ ਸਾਰਾ ਕੁਛ ਟੈਕਨੋਲਜੀ ਕਰਕੇ ਹੀ ਮੁਮਕਿਨ ਹੋਇਆ ਹੈ ਅਤੇ ਮੈਂ ਤਾਂ ਭਾਰਤ ਸਰਕਾਰ ਨੂੰ ਅਤੇ ਤੈਕਨੋਲਜੀ ਨੂੰ ਬਹੁਤ ਹੀ ਧੰਨਵਾਦ ਕਰਦਾ ਹਾਂ ਧੰਨਵਾਦ